ਹਾਲ ਫਿਲਹਾਲ ਹੀ ਕੁਝ ਸਮੇਂ ਪਹਿਲਾਂ ਮੈਂ ਇੱਕ ਬਾਈਕਿੰਗ ਸਮਾਗਮਾਂ ਵਿੱਚ ਹਿੱਸਾ ਲਿੱਤਾ ਜਿਸ ਵਿੱਚ ਬਹੁਤ ਸਾਰੇ ਬਾਈਕਰਸ ਮੌਜੂਦ ਸੀ ਲਗਭਗ ਦਸ ਤੋਂ ਪੰਦਰ੍ਹਾਂ ਦਸ ਤੋਂ ਗਿਆਰ੍ਹਾਂ ਬਾਈਕਰ ਉਹ ਸਮਾਗਮਾਂ ਵਿੱਚ ਮੌਜੂਦ ਸੀ ਸੰਗਠਿਤ ਸੀ ਅਤੇ ਇਸ ਅਨੁਭਵ ਮੇਰਾ ਬਹੁਤ ਹੀ ਅੱਛਾ ਰਿਹਾ ਇਹ ਜਿਹੜਾ ਮੇਰਾ ਅਨੁਭਵ ਸੀ ਇਸ ਅਨੁਭਵ ਦੇ ਵਿੱਚ ਇਸ ਬਾਈਕਿੰਗ ਸਮਾਗਮਾਂ ਵਿੱਚ ਮੈਂ ਅਲੱਗ ਅਲੱਗ ਦੇਸ਼ ਦੇ ਸਥਾਨਾਂ ਵਿੱਚ ਜਾ ਕੇ ਟਰੈਵਲ ਕੀਤਾ ਅਤੇ ਇਸ ਸੰਗਠਿਤ ਜੋ ਹੁੰਦਾ ਹੈ ਇਸ ਵਿੱਚ ਜਿਹੜੇ ਵੀ ਬਾਈਕਰਸ ਹੁੰਦੇ ਨੇ ਉਹਨਾਂ ਨੂੰ ਰਾਈਡਰ ਕਿਹਾ ਜਾਂਦਾ ਹੈ ਅਤੇ ਇਸ ਸਮਾਗਮਾਂ ਵਿੱਚ ਅਲੱਗ ਅਲੱਗ ਜਗ੍ਹਾ ਤੋਂ ਲੋਕ ਆਏ ਹੋਏ ਸਨ ਕੁਝ ਯੂਟੀਊਬ 'ਤੇ ਆਪਣੇ ਚੈਨਲ ਬਣਾ ਕੇ ਉਹਨਾਂ ਨੇ ਇਹ ਪੂਰਾ ਆਪਦਾ ਬਾਈਕ ਦਾ ਵਲੋਗ ਬਣਾਉਂਦੇ ਸੀ ਅਤੇ ਉਹਨੂੰ ਅਪਲੋਡ ਕਰਦੇ ਸੀ ਉਹਨਾਂ ਨੂੰ ਵੇਖ ਕੇ ਮੈਂ ਵੀ ਇੱਕ ਚੈਨਲ ਆਪਦਾ ਸ਼ੁਰੂ ਕੀਤਾ ਅਤੇ ਮੈਂ ਆਪਦੀ ਲਾਸਟ ਜਿਹੜੀ ਰਾਈਡ ਸੀ ਦੋ ਜਾਂ ਤਿੰਨ ਰਾਈਡਸ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਕੈਮਰੇ ਵਿੱਚ ਕੈਦ ਕੀਤਾ ਅਤੇ ਉਸ ਨੂੰ ਯੂਟਿਊਬ ਉੱਪਰ ਮੈਂ ਅਪਲੋਡ ਕੀਤਾ ਇਹ ਮੇਰਾ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਮੈਂ ਇਸ ਵਿੱਚ ਅਲੱਗ ਅਲੱਗ ਸਥਾਨਾਂ 'ਤੇ ਗਿਆ ਇਹ ਰਾਈਡ ਸਾਡੀ ਫਾਜ਼ਿਲਕਾ ਤੋਂ ਮੈਂ ਅਕੇਲੇ ਸ਼ੁਰੂ ਕੀਤੀ ਸੀ ਅਤੇ ਦਿੱਲੀ ਜਾ ਕੇ ਅਸੀਂ ਸਾਰੇ ਮਿਲੇ ਸੀ ਸਭ ਤੋਂ ਪਹਿਲਾਂ ਅਸੀਂ ਜੈਪੁਰ ਗਏ ਸੀ ਜਿਸ ਵਿੱਚ ਜਦੋਂ ਵੀ ਅਸੀਂ ਜਾਂਦੇ ਆ ਕੁਝ ਕੁ ਸਮੇਂ ਬਾਅਦ ਅਸੀਂ ਢਾਬੇ ਜਾਂ ਫਿਰ ਕਿਸੇ ਹੋਟਲ ਦੇ ਜਗ੍ਹਾ ਅਸੀਂ ਰੁਕਦੇ ਹਾਂ ਜਿੱਥੇ ਅਸੀਂ ਨਾਸ਼ਤਾ ਕਰਦੇ ਹਾਂ ਖਾਣਾ ਖਾਂਦੇ ਹਾਂ ਫਰੈਸ਼ ਹੁੰਦੇ ਹਾਂ ਜੋ ਵੀ ਸਾਨੂੰ ਲੋੜ ਹੁੰਦੀ ਅਸੀਂ ਉਹ ਕਰਦੇ ਹਾਂ ਅਤੇ ਇਹ ਇਹ ਜੋ ਵੀ ਕੈਮਰੇ ਹੁੰਦੇ ਹਨ ਯੂਟਿਉਬਰ ਹੁੰਦੇ ਨੇ ਉਹ ਆਪਦੇ ਕੈਮਰੇਜ ਨੂੰ ਆਪਣੇ ਹੈਲਮੇਟ ਦੇ ਉੱਪਰ ਲਾ ਕੇ ਪੂਰਾ ਸਫਰ ਰਿਕਾਰਡ ਕਰਦੇ ਹਨ ਸਫਰ ਦੇ ਦੌਰਾਨ ਅਸੀਂ ਅਲੱਗ ਅਲੱਗ ਤਰੀਕੇ ਦੇ ਐਕਸਪੀਰੀਅੰਸ ਕਰਦੇ ਹਾਂ ਅਸੀਂ ਬੜੀ ਬੜੀ ਨਦੀਆਂ ਵੇਖਦੇ ਹਾਂ ਅਸੀਂ ਅਲੱਗ ਅਲੱਗ ਦੇਸ਼ ਦੇ ਮਸ਼ਹੂਰ ਪੁਰਾਣੇ ਸਥਾਨਾਂ ਨੂੰ ਵੇਖਦੇ ਹਾਂ ਇਹ ਇਹ ਸਫਰ ਦੇ ਵਿੱਚ ਸਾਨੂੰ ਅਲੱਗ ਅਲੱਗ ਤਰੀਕੇ ਦੇ ਦ੍ਰਿਸ਼ ਵਿਖਦੇ ਹਨ ਜਿਵੇਂ ਕਿ ਸੜਕਾਂ ਦੇ ਕਈ ਵਾਰੀ ਦੁਖਦ ਐਕਸੀਡੈਂਟ ਹੋ ਜਾਂਦੇ ਹਨ ਅਤੇ ਕਿਤੇ ਲੜਾਈ ਝਗੜੇ ਵੀ ਹੁੰਦੇ ਹਨ ਪਰ ਇਹ ਸਾਰਾ ਇੱਕ ਬਾਈਕਿੰਗ ਦਾ ਸਫਰ ਦਾ ਇੱਕ ਹਿੱਸਾ ਹੈ ਇਹ ਇਸ ਨੂੰ ਅਸੀਂ ਪੋਜੀਟਿਵ ਹੀ ਲੈਂਦੇ ਹਾਂ ਜਦੋਂ ਅਸੀਂ ਦਿੱਲੀ ਤੋਂ ਅਸੀਂ ਜੈਪੁਰ ਗਏ ਅਸੀਂ ਅਲੱਗ ਅਲੱਗ ਤਰੀਕੇ ਦੇ ਐਕਸਪੀਰੀਅੰਸ ਲਿਤੇ ਉਸ ਐਕਸਪੀਰੀਅੰਸ ਦੇ ਨਾਲ ਸਾਨੂੰ ਬਹੁਤ ਹੀ ਅੱਛਾ ਲੱਗਿਆ ਮੈਂ ਉਹ ਸਾਰੇ ਐਕਸਪੀਰੀਅੰਸ ਨੂੰ ਕੈਮਰੇ ਵਿੱਚ ਕੈਦ ਕਰਕੇ ਆਪਦੇ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਅਤੇ ਅਸੀਂ ਜਦੋਂ ਉੱਥੇ ਪਹੁੰਚੇ ਅਸੀਂ ਨਵੇਂ ਬਾਈਕਿੰਗ ਸਮਾਗਮਾਂ ਨੂੰ ਅਸੀਂ ਮਿਲੇ ਜੋ ਕਿ ਅੱਗੋਂ ਆ ਮੁੰਬਈ ਵਾਲੀ ਸਾਈਡ ਤੋਂ ਆ ਰਹੇ ਸੀ ਉਹਨਾਂ ਨੇ ਆਪਦਾ ਐਕਸਪੀਰੀਅੰਸ ਸ਼ੇਅਰ ਕੀਤਾ ਇਹ ਸਮਾਗਮਾਂ ਖਤਮ ਹੋਣ ਤੋਂ ਬਾਅਦ ਇਹ ਇਹ ਸਫਰ ਖਤਮ ਹੋਣ ਤੋਂ ਬਾਅਦ ਅਸੀਂ ਜ ਜੰਮੂ ਕਸ਼ਮੀਰ ਦੀ ਤਰਫ ਚਲੇ ਗਏ ਜੰਮੂ ਕਸ਼ਮੀਰ ਜਾਣ ਲਈ ਤੁਹਾਨੂੰ ਸਪੈਸ਼ਲ ਕੱਪੜੇ ਅਤੇ ਇਕਿਪਮੈਂਟ ਦੀ ਲੋੜ ਪੈਂਦੀ ਹੈ ਇਹ ਸਫਰ ਦੇ ਵਿੱਚ ਜ਼ਿਆਦਾ ਲੋਕ ਨਹੀਂ ਸੀ ਸਿਰਫ ਪੰਜ ਲੋਕ ਹੀ ਗਏ ਸੀ ਮੇਰੇ ਨਾਲ ਇਹ ਇਸ ਉਸ ਜੰਮੂ ਕਸ਼ਮੀਰ ਦੀ ਸੜਕਾਂ ਪਹਾੜਾਂ ਵਿੱਚ ਬਹੁਤ ਹੀ ਖਤਰਨਾਕ ਹੋ ਜਾਂਦੀ ਹੈ ਜਿੱਥੇ ਤੁਹਾਡਾ ਇੱਕ ਤਰਫ ਖਾਈ ਅਤੇ ਇੱਕ ਤਰਫ ਪਹਾੜ ਹੁੰਦਾ ਜਾਂ ਜਿੱਥੇ ਤੁਹਾਨੂੰ ਬਹੁਤ ਹੀ ਸਾਵਧਾਨੀ ਨਾਲ ਸਫਰ ਕਰਨਾ ਪੈਂਦਾ ਹੈ ਅਤੇ ਅਤੇ ਇਸ ਕਰਕੇ ਨਾ ਤੁਹਾਨੂੰ ਬਹੁਤ ਹੀ ਸਾਵਧਾਨੀ ਨਾਲ ਸਫਰ ਕਰਨਾ ਚਾਹੀਦਾ ਹੈ ਤਾਂ ਕਰਕੇ ਅਸੀਂ ਮੈਂ ਪੂਰੇ ਸਫਰ ਨੂੰ ਆਪਦੇ ਕੈਮਰੇ ਅੰਦਰ ਕੈਦ ਕੀਤਾ ਅਤੇ ਮੈਂ ਅੱਗੇ ਵੀ ਇਸ ਤਰੀਕੇ ਦੇ ਸਫਰ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਇਹ ਸਾਰਾ ਕੁਝ ਮੇਰੇ ਯੂਟੀਊਬ ਚੈਨਲ 'ਤੇ ਅਵੇਲੇਬਲ ਹੈ ਅਤੇ ਮੈਂ ਆਣ ਵਾਲੇ ਸਮੇਂ ਅੰਦਰ ਕਿਸੇ ਰੇਸ ਦੇ ਅੰਦਰ ਵੀ ਹਿੱਸਾ ਲੈਣਾ ਚਾਹੁੰਦਾ ਹਾਂ ਜੋ ਕਿ ਐਵੇਂ ਹੀ ਸੜਕ ਦੇ ਉੱਤੇ ਕੀਤੀ ਜਾਂਦੀ ਹੈ ਪਰ ਇਹ ਸਰਕਾਰ ਦੀ ਪਰਮਿਸ਼ਨ ਲੈ ਕੇ ਹੀ ਰੇਸ ਹੁੰਦੀ ਹੈ ਤਾਂ ਕਰਕੇ ਮੈਂ ਇਹ ਸਭ ਲਈ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਇਹੋ ਜਿਹੇ ਹੀ ਐਕਸਪੀਰੀਅੰਸ ਮੈਂ ਹੋਰ ਆਪਦੀ ਲਾਈਫ ਦੇ ਅੰਦਰ ਲਵਾਂ ਇਹ ਸਮਾਗਾਮਾਂ ਸਾਨੂੰ ਬਹੁਤ ਕੁਝ ਲਾਈਵ ਬਾਰੇ ਸਿਖਾਉਂਦਾ ਹੈ ਕਿ ਕਿਵੇਂ ਸਾਨੂੰ ਸੜਕ 'ਤੇ ਚਲਦੇ ਸਮੇਂ ਪੂਰੇ ਹੀ ਹੈਲਮੇਟ ਸਾਡੇ ਕੱਪੜੇ ਪ੍ਰੋਪਰ ਬਾਈਕਿੰਗ ਰਾਈਡਿੰਗ ਵਾਸਤੇ ਪ੍ਰੋਪਰ ਲੈ ਕੇ ਜਾਣੇ ਚਾਹੀਦੇ ਹਨ ਅਗਰ ਕੋਈ ਵੀ ਲਾਪਰਵਾਹੀ ਹੁੰਦੀ ਹੈ ਅਤੇ ਤੁਹਾਡੀ ਜਾਨ ਜਾਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਜੋ ਕਿ ਮੈਂ ਐਕਸੀਡੈਂਟ ਬਾਰੇ ਤੁਹਾਨੂੰ ਦੱਸਿਆ ਸੀ ਇਸ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਨੂੰ ਬੜੀ ਸਾਵਧਾਨੀ ਨਾਲ ਅਤੇ ਇੱਕ ਸਲੋ ਸਪੀਡ 'ਤੇ ਹੀ ਸਾਨੂੰ ਰਾਈਡ ਕਰਨਾ ਚਾਹੀਦਾ ਹੈ ਮੈਂ ਵੇਖਿਆ ਹੈ ਕਿ ਕੁਝ ਨੌਜਵਾਨ ਬਹਤ ਹੀ ਤੇਜ਼ੀ ਨਾਲ ਇਹ ਰੇਸਾਂ ਕਰਨੀ ਸ਼ੁਰੂ ਕਰ ਦਿੰਦੇ ਹਨ ਬਿਨਾਂ ਕਿਸੇ ਸਾਵਧਾਨੀ ਤੋਂ ਬਿਨਾਂ ਕਿਸੀ ਸਰਕਾਰ ਦੀ ਪਰਮਿਸ਼ਨ ਤੋਂ ਜਿਸ ਕਾਰਨ ਸੜਕ 'ਤੇ ਸਾਨੂੰ ਬਹੁਤ ਹੀ ਜ਼ਿਆਦਾ ਐਕਸੀਡੈਂਟ ਵੇਖਣ ਨੂੰ ਮਿਲਦੇ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਬਹੁਤ ਹੀ ਸਾਵਧਾਨੀ ਨਾਲ ਇਹ ਸਭ ਕੁਝ ਕਰੀਏ ਅਤੇ ਸਾਨੂੰ ਆਪਦੇ ਮਾਂ ਪਿਉ ਪਿਉ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਬਾਅਦ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਇਸ ਦੁਨੀਆਂ ਦੇ ਵਿੱਚ ਇਸ ਲਈ ਸਾਨੂੰ ਇਹ ਸਭ 'ਚ ਚੀਜ਼ਾਂ ਨੂੰ ਸਿਰਫ ਖੁਸ਼ੀ ਲਈ ਆਪਦੇ ਪੂਰੀ ਸੇਫਟੀ ਨਾਲ ਕਰਨਾ ਚਾਹੀਦਾ ਹੈ ਆਉਣ ਵਾਲੇ ਸਮੇਂ ਅੰਦਰ ਮੈਂ ਐਵੇਂ ਹੀ ਬਾਈਕਿੰਗ ਸਮਾਗਮ ਵਿੱਚ ਹਿੱਸਾ ਲਵਾਂਗਾ ਅਤੇ ਪਰ ਪੂਰੀ ਹੀ ਸਾਵਧਾਨੀ ਨਾਲ ਕਰਾਂਗਾ ਬਹੁਤ ਬਹੁਤ ਧੰਨਵਾਦ